ਸਾਡੇ ਪਿੰਡ ਵਿੱਚ ਨਾ ਇੱਕ ਦਿਨ ਚੋਰੀ ਹੋਈ ਸੀ ਅਤੇ ਚੋਰੀ ਹੋਈ ਰਾਤ ਦੇ ਟਾਈਮ ਕੋਈ ਦੋ ਕੁ ਵੱਜੇ ਹੋਏ ਸੀਗੇ ਅਤੇ ਉਹ ਸਾਰੇ ਸੁੱਤੇ ਹੋਏ ਸੀ ਚੋਰ ਨਾ ਕਾਫ਼ੀ ਦਿਨ ਤੋਂ ਉਹਨਾਂ ਨੂੰ ਨੋਟ ਕਰ ਰਹੇ ਸੀ ਇਹ ਕਿ ਘਰੇ ਕਿੱਦਾਂ ਰਹਿੰਦੇ ਆ ਕਿੱਦਾਂ ਰਹਿਣ ਸਹਿਣ ਉਹਨਾਂ ਦਾ ਕੀ ਬੋਲ ਚਾਲ ਆ ਅਗਰ ਉਹ ਬੰਦੇ ਕਿ ਜ਼ਿਆਦਾ ਉਹ ਅਮੀਰ ਆ ਕਿੱਦਾਂ ਵਾ ਸਾਰਾ ਹਿਸਾਬ ਕਿਤਾਬ ਉਹ ਦੇਖਣ ਦੇ ਸੀਗੇ ਫਿਰ ਇੱਕ ਦਿਨ ਉਹਨਾਂ ਨੇ ਚੋਰੀ ਕਰ ਹੀ ਲਈ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਇੰਨੇ ਪੈਸੇ ਚੋਰੀ ਹੋ ਗਏ ਆ ਤਾਂ ਉਹ ਚੋਰਾਂ ਨੇ ਪਤਾ ਕੀ ਕੀਤਾ ਉਸ ਬੰਦੇ ਨੂੰ ਵੀ ਮਾਰਤਾ ਇੰਨੀ ਹਿੰਮਤ ਵੱਧ ਗਈ ਹੋਈ ਆ ਅੱਜ ਕੱਲ੍ਹ ਲੋਕਾਂ ਦੀ ਕਿ ਉਹਨੂੰ ਉਹ ਚੋਰਾਂ ਨੇ ਉਹਨੂੰ ਮਾਰ ਵੀ ਦਿੱਤਾ ਕਾਫ਼ੀ ਪੁਲਿਸ ਆਈ ਬੜੀ ਤਹਿਕੀਕਾਤ ਕਰਨ ਤੋਂ ਬਾਅਦ ਮਤਲਬ ਕਿ ਉਹ ਬੰਦੇ ਜਿਹੜੇ ਲੱਭੇ ਫਿਰ ਉਹ ਉਹਨਾਂ ਉਹ ਬੰਦੇ ਜਿਹੜੇ ਸੀ ਉਹ ਦੇਖਣ ਨੂੰ ਬੜੇ ਅਮੀਰ ਘਰ ਦੇ ਲੱਗਦੇ ਸੀਗੇ ਕਿ ਐਂ ਰਹਿੰਦੇ ਹੁੰਦੇ ਸੀ ਐਂ ਰਹਿੰਦੇ ਸੀਗੇ ਅਤੇ ਉਹਨਾਂ ਦੇ ਕੱਪੜੇ ਵੀ ਬੜੇ ਅੱਛੇ ਸੀ ਬਟ ਉਹ ਚੋਰ ਸੀਗੇ ਅੱਜ ਕੱਲ੍ਹ ਦੇ ਤਾਂ ਚੋਰਾਂ ਦਾ ਵੀ ਨਹੀਂ ਪਤਾ ਲੱਗਦਾ ਕਦੋਂ ਕਿੱਥੇ ਇਸ ਕਰਕੇ ਧਿਆਨ ਰੱਖਣਾ ਚਾਹੀਦਾ ਆਪਣਾ ਆਪਣੇ ਆਪ ਦਾ ਉਹ ਘਟਨਾ ਨੂੰ ਦੇਖ ਕੇ ਮੇਰੇ ਮਨ ਦੇ ਅੰਦਰ ਬੜਾ ਹੋਇਆ ਕਿ ਅੱਜ ਕੱਲ੍ਹ ਦੁਨੀਆਂ 'ਚ ਹੋ ਕੀ ਰਿਹਾ ਵਾ ਪਿੰਡਾਂ ਦੇ ਵਿੱਚ ਅਈ ਇੰਨੀਆਂ ਚੋਰੀਆਂ ਹੁੰਦੀਆਂ ਵਾ ਤਾਂ ਸ਼ਹਿਰਾਂ 'ਚ ਕੀ ਹੁੰਦਾ ਹੋਊਗਾ ਪਿੰਡ ਦੇ ਲੋਕ ਤਾਂ ਵੈਸੇ ਹੀ ਬੜਾ ਡਰ ਜਾਂਦੇ ਆ ਅਗਰ ਇਹ ਕੋਈ ਗੱਲ ਹੁੰਦੀ ਆ ਵੈਸੇ ਵੀ ਪਿੰਡਾਂ ਦੇ ਵਿੱਚ ਨਾ ਘਰ ਘਰ ਖੁੱਲੇ ਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਇੰਨਾ ਹੁੰਦਾ ਨਹੀਂ ਆ ਡਰ ਨਹੀਂ ਹੁੰਦਾ ਬਟ ਅੱਜ ਕੱਲ੍ਹ ਦੇ ਤਾਂ ਪਿੰਡਾਂ ਵਾਲਿਆਂ ਨੂੰ ਵੀ ਬੜਾ ਡਰ ਹੋ ਗਿਆ ਵਾ ਕਿਉਂਕਿ ਪਿੰਡਾਂ 'ਚ ਵੀ ਬੜੀਆਂ ਚੋਰੀਆਂ ਹੋਣ ਲੱਗ ਗਈਆਂ ਵਾ ਉਹ ਘਟਨਾ ਨਾ ਉਹ ਘਟਨਾ ਕਰਕੇ ਸਾਰੇ ਫਿਰ ਮਤਲਬ ਕਿ ਸਰਪੰਚ ਨੂੰ ਦੱਸਿਆ ਗਿਆ ਸਾਰੀ ਕਾਰਵਾਈ ਕੀਤੀ ਗਈ ਫਿਰ ਕਾਫ਼ੀ ਸਮੇਂ ਬਾਅਦ ਜਾ ਕੇ ਉਹ ਚੋਰ ਲੱਭੇ ਫਿਰ ਉਹਨਾਂ ਚੋਰਾਂ ਤ 'ਤੇ ਐਕਸ਼ਨ ਲਿੱਤਾ ਗਿਆ ਅਤੇ ਉਹਨਾਂ ਨੂੰ ਜਿਨ ਉਹਨਾਂ ਨੇ ਨਾ ਜਿਹੜੇ ਬੰਦੇ ਨੂੰ ਮਾਰਤਾ ਸੀ ਨਾ ਉਹ ਕਿਉਂਕਿ ਉਹਨਾਂ ਉਹਨੇ ਉਹਨਾਂ ਨੂੰ ਚੋਰੀ ਕਰ ਉਹ ਰਾਤੀਂ ਉਠਿਆ ਪਾਣੀ ਪੀਣ ਲਈ ਅਤੇ ਉਦੋਂ ਉਹਨੇ ਉਹਨਾਂ ਨੇ ਖੜਾ ਉਹਨੇ ਖੜਾਕ ਸੁਣ ਲਿਆ ਅਤੇ ਉਹ ਜਦੋਂ ਦੇਖਣ ਗਿਆ ਤਾਂ ਉਹਨੇ ਉਹਨਾਂ ਨੂੰ ਦੇਖ ਲਿਆ ਸੀ ਇਸ ਕਰਕੇ ਉਹਨਾਂ ਨੇ ਗੋਲੀ ਮਾਰਤੀ ਉਹਨੂੰ ਅਤੇ ਗੋਲੀ ਮਾਰ ਕਿਉਂਕਿ ਉਹ ਇਕੱਲਾ ਸੀ ਉਸ ਟਾਈਮ ਸਾਰੇ ਘਰਦੇ ਉਹਦੇ ਗਏ ਸੀ ਵਿਆਹ 'ਤੇ ਅਤੇ ਉਹ ਇਕੱਲਾ ਸੀ ਇੱਕ ਬੰਦਾ ਘਰ ਉਹਨਾਂ ਨੇ ਨੌਕਰ ਛੱਡਿਆ ਹੋਇਆ ਸੀਗਾ ਅਤੇ ਉਹਨੇ ਉਹਨਾਂ ਨੂੰ ਵੀ ਉਹਨੂੰ ਹੀ ਮਾਰ ਦਿੱਤਾ ਜਿਹਦੇ ਕਰਕੇ ਕਿ ਅੱਜ ਕੱਲ੍ਹ ਸੇਫ ਨਹੀਂ ਆ ਇਸ ਕਰਕੇ ਆਪਣੀ ਕੇਅਰ ਆਪੇ ਕਰਨੀ ਚਾਹੀਦੀ ਆ ਬੰਦੇ ਨੂੰ